ਅਠਾਰਾਂ ਜਨਵਰੀ ਦੋ ਹਜ਼ਾਰ ਚੋਵੀ ਤੀਹ ਜੂਨ ਦੋ ਹਜ਼ਾਰ ਉਣੱਤੀ ਉਣੱਤੀ ਸਤੰਬਰ ਦੋ ਹਜ਼ਾਰ ਤੀਹ ਪੱਚੀ ਮਈ ਦੋ ਹਜ਼ਾਰ ਛੱਬੀ ਅਠਾਰਾਂ ਨਵੰਬਰ ਦੋ ਹਜ਼ਾਰ ਪੈਂਤੀ